ਰਾਜ ਸਿਹਤ ਸੰਭਾਲ ਪੇਸ਼ੇਵਰਾਂ ਲਈ ਅਕੁਟ ਢੁਕਵੀਂ ਸਿਲਾ ਸਿਖਲਾਈ ਜਿਹੜੀ ਹੈ ਉਹ ਇਸ ਤਰ੍ਹਾਂ ਹੋ ਸਕਦੀ ਹੈ ਕਿ ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਨੇ ਨਰਸਿੰਗ ਕਰਕੇ ਆਉਂਦੇ ਹਨ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਜਾਣ ਪ੍ਰਾਈਵੇਟ ਜਿਹੜੇ ਨੇ ਉਹ ਹਸਪਤਾਲਾਂ ਨਾਲੋਂ ਉਹਨਾਂ ਨੂੰ ਗੌਰਮੈਂਟ ਜਿਹੜੇ ਛੋਟੇ ਛੋਟੇ ਕੇਂਦਰ ਖੋਲ੍ਹੇ ਜਾਣ ਜਗ੍ਹਾ ਜਗ੍ਹਾ ਹਰ ਇੱਕ ਸ਼ਹਿਰ ਦੇ ਵਿੱਚ ਜਾਂ ਹਰ ਇੱਕ ਗਲੀ ਮੁਹੱਲੇ ਦੇ ਬਾਹਰ ਜਦੋਂ ਖੋਲ੍ਹਿਆ ਜਾਵੇਗਾ ਕਿਸੇ ਵੀ ਚੀਜ਼ ਨੂੰ ਇਹ ਐਸੀ ਕਿਸੇ ਕੇਂਦਰ ਨੂੰ ਖੋਲ੍ਹਿਆ ਜਾਵੇਗਾ ਤੇ ਉਹ ਲੋਕਾਂ ਨੂੰ ਬਹੁਤ ਫ਼ਾਇਦਾ ਮਿਲੇਗਾ ਉਹਦੇ ਨਾਲ ਲੋਕਾਂ ਨੂੰ ਇੱਥੇ ਤੱਕ ਕਿ ਇਹਨਾਂ ਕੇਂਦਰਾਂ ਕਰਕੇ ਹੀ ਤਾਂ ਲੋਕਾਂ ਦਾ ਵੱਡੇ ਵੱਡੇ ਹਸਪਲਾ ਹਸਪਤਾਲਾਂ ਚੋਂ ਇੰਨਾਂ ਖਰਚਾ ਹੋਣ ਤੋਂ ਬਚੇਗਾ ਜੇਕਰ ਲੋਕਾਂ ਦੇ ਕੋਲ ਹੀ ਇਹ ਕੇਂਦਰ ਹੋਣਗੇ ਤਾਂ ਲੋਕ ਜਲਦੀ ਤੋਂ ਜਲਦੀ ਆਪਣੀ ਬਿਮਾਰੀ ਦਾ ਛੁਟਕਾਰਾ ਪਾਉਣ ਦੇ ਲਈ ਜਿੰਨੀ ਜਲਦੀ ਹੋ ਸਕੇਗਾ ਉਹ ਇਹਨਾਂ ਡਿਸਪੈਂਸਰੀਆਂ ਤੇ ਜਾ ਕੇ ਚੈੱਕ ਕਰਾਉਣਗੇ ਜਿਹਦੇ ਨਾਲ ਕੀ ਹੈ ਕਿਸੇ ਨੂੰ ਇੱਕ ਤਰ੍ਹਾਂ ਦਾ ਰੋਜ਼ਗਾਰ ਵੀ ਮਿਲ ਜਾਂਦਾ ਹੈ ਔਰ ਕਿਸੇ ਦੀ ਜ਼ਰੂਰਤ ਵੀ ਪੂਰੀ ਹੋ ਜਾਂਦੀ ਹੈ